ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਜੀ ਕੌਣ ਜੀ ਹਾਂਜੀ ਹਾਂਜੀ

ਅੱਛਾ ਜੀ ਚਾਰ ਵਾਸਤੇ ਗੱਡੀ ਹੋਜੂਗੀ ਜੀ ਗੱਡੀ ਤੁਹਾਨੂੰ ਪ੍ਰੋਵਾਇਡ ਕਰਵਾ ਦਾਂਗੇ ਆਪਾਂ ਜੀ ਉਹਦਾ ਮੰਨ ਕੇ ਚੱਲੋ ਦੋ ਕੁ ਹਜ਼ਾਰ ਰੁਪਈਆ ਰੈਂਟ ਹੋਏਗਾ ਜੀ ਉਹਦਾ ਭਿੱਖੀ ਤੋਂ ਤਲਵੰਡੀ ਦਾ ਜੀ ਹਾਂਜੀ ਹਾਂਜੀ ਭਿੱਖੀ ਤੋਂ ਤੁਸੀਂ ਜੀ ਅੱਛਾ ਜੀ ਨਹੀਂ ਰਸ਼ ਤਾਂ ਦੇਖੋ ਰਸ਼ ਤਾਂ ਦੇਖੋ ਹੁੰਦਾ ਹੀ ਹੈ ਜੀ ਭੀੜ ਬਹੁਤ ਹੁੰਦੀ ਹੈਗੀ ਹੋਲਾ ਮਹੱਲਾ ਹੈਗਾ ਹੈ ਨਾ ਜੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਸੇਵਾ ਕਰਵਾਵਾਂਗੇ ਜੀ ਜਲਦੀ ਤੁਹਾਨੂੰ ਅਸੀਂ ਮੱਥਾ ਟਿਕਵਾ ਦਾਂਗੇ ਤੁਹਾਡਾ ਕੋਈ ਚੱਕਰ ਨਹੀਂ ਰਹਿਣ ਦੀ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਹੋਟਲ ਕਰਵਾ ਦਾਂਗੇ ਤੁਹਾਡਾ ਜੀ ਜਾਂ ਸਰਾਂ ਵਗੈਰਾ ਹੁੰਦੀਆਂ ਨੇ ਉੱਥੇ ਤੁਹਾਨੂੰ ਰੁਕਵਾ ਦਾਂਗੇ ਕੋਈ ਚੱਕਰ ਨਹੀਂ ਜੀ ਫੇਰ

ਕੋਈ ਗੱਲ ਨਹੀਂ ਜੀ ਉਹ ਮੌੌਕੇ 'ਤੇ ਥੋੜ੍ਹਾ ਬਹੁਤ ਆਪਾਂ ਦੇਖ ਲਵਾਂਗੇ ਜੀ ਕੋਈ ਚੱਕਰ ਨਹੀਂ ਹੈਗਾ ਤੁਸੀਂ ਆਓ ਜਦੋਂ ਤੁਹਾਡਾ ਮੂਡ ਬਣਿਆ ਤੁਸੀਂ ਪਲਾਨ ਬਣਾਇਆ ਤੁਸੀਂ ਮੈਨੂੰ ਦੱਸਿਓ

ਹਾਂਜੀ ਹਾਂਜੀ ਹਾਂਜੀ ਠੀਕ ਜੀ ਕੋਈ ਗੱਲ ਨਹੀਂ ਓਕ ਓਕੇ ਬਾਏ ਜੀ